ਯੋਗਾ ਬਹੁਤ ਹੀ ਵਧੀਆ ਚੀਜ਼ ਹੈ ਮੈਂ ਜਿਹਨੂੰ ਜਿਹੜੀ ਫਿੱਟਨੈੱਸ ਨੂੰ ਬਹੁਤ ਤਵੱਜੋਂ ਦਿੰਦੀ ਹਾਂ ਅਗਰ ਮੈਂ ਦੇਖਾਂ ਤਾਂ ਮੈਨੂੰ ਬਾਈ ਸਾਲ ਦੀ ਉਮਰ 'ਚ ਹੀ ਹਾਈ ਬੀ ਪੀ ਦੀ ਪ੍ਰੋਬਲਮ ਰਹਿਣ ਲੱਗ ਗਈ ਸੀ ਅਤੇ ਜੇ ਮੈਂ ਯੋਗਾ ਵੱਲ ਗਈ ਤਾਂ ਮੇਰਾ ਬੀ ਪੀ ਬੜਾ ਹੀ ਵਧੀਆ ਠੀਕ ਰਹਿਣ ਲੱਗ ਗਿਆ ਅਤੇ ਮੇਰਾ ਜਿਹੜਾ ਸਟ੍ਰੈੱਸ ਲੈਵਲ ਸੀ ਉਹ ਵੀ ਬਹੁਤ ਘੱਟ ਹੋਇਆ ਮੈਂ ਬਹੁਤ ਟੈਂਸ਼ਨ ਲੈਂਦੀ ਸੀ ਮੈਂ ਛੋਟੇ ਛੋਟੇ ਕੰਮ ਦੀ ਬੜੀ ਹਰ ਟਾਈਮ ਸਟ੍ਰੈੱਸ ਲੈਂਦੀ ਸੀ ਬਹੁਤ ਪੈਨਿਕ ਹੁੰਦੀ ਸੀ ਨੈਗੇਟਿਵ ਐਨਰਜੀ ਮੇਰੇ 'ਚ ਬਹੁਤ ਜ਼ਿਆਦਾ ਸੀ ਪਰ ਜੇ ਮੈਂ ਯੋਗਾ ਨੂੰ ਨੂੰ ਦੇਖਿਆ ਤਾਂ ਮੈਂ ਮੈਨੂੰ ਬਹੁਤ ਹੀ ਲਾਭ ਹੋਇਆ ਅਤੇ ਜੇ ਮੈਂ ਆਪਣੀ ਮਦਰ ਨਾਲ ਆਪਣੀ ਮਾਂ ਨਾਲ ਗੱਲ ਕੀਤੀ ਹੈ ਜੋ ਹੁਣ ਪਚਵੰਜਾ ਦੇ ਨੇੜੇ ਹੈ ਉਹ ਵੀ ਇਹ ਹੀ ਕਹਿੰਦੇ ਨੇ ਕਿ ਉਹਨਾਂ ਨੂੰ ਯੋਗਾ ਨੇ ਬੜਾ ਫ਼ਾਇਦਾ ਦਿੱਤਾ ਹੈ ਉਹ ਕਹਿੰਦੇ ਆ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਸੀ ਉਹਨਾਂ ਨੂੰ ਅਸਥਮਾ ਸੀ ਅਤੇ ਜੇ ਉਹਨਾਂ ਨੇ ਯੋਗਾ ਕੀਤੀ ਤਾਂ ਉਹਨਾਂ ਦੀ ਸਾਹ ਦੀ ਪ੍ਰੋਬਲਮ ਬੜੀ ਹੀ ਠੀਕ ਹੋਈ ਹੈ ਉਹਦੇ ਨਾਲ ਜੇ ਹੋਰ ਵੀ ਦੇਖਿਆ ਜਾਵੇ ਤਾਂ ਮੈਂਟਲ ਪੀਸ ਬੜੀ ਹੀ ਠੀਕ ਰਹਿੰਦਾ ਹੈ ਯੋਗਾ ਦੇ ਨਾਲ ਜੇ ਤੁਹਾਨੂੰ ਕੋਈ ਹੋਰ ਬਿਮਾਰੀ ਹੈ ਜਿਵੇਂ ਹਾਈ ਬੀ ਪੀ ਸ਼ੂਗਰ ਜਾਂ ਕੋਈ ਗੋਡੇ ਦੁੱਖਦੇ ਹੈ ਤਾਂ ਯੋਗਾ ਦੇ ਨਾਲ ਸਾਨੂੰ ਬਹੁਤ ਫ਼ਾਇਦਾ ਹੁੰਦਾ ਹੈ ਯੋਗਾ 'ਚ ਬਹੁਤ ਸਾਰੇ ਆਸਣ ਹੁੰਦੇ ਹੈ ਜਿਵੇਂ ਬਾਲ ਆਸਣ ਹੋਰ ਵੀ ਬੜੇ ਬੜੇ ਆਸਣ ਹੁੰਦੇ ਹੈ ਜੋ ਸਾਡੀ ਮੱਦਦ ਕਰਦੇ ਹੈ ਜੇ ਖਾਣੇ ਨੂੰ ਪਚਾਉਣ ਲਈ ਵੀ ਆਸਣ ਹੈ ਸੁਬਾਹ ਉੱਠ ਕੇ ਜੇ ਸਵੇਰੇ ਉੱਠ ਕੇ ਅਸੀਂ ਖਾਲੀ ਪੇਟ ਆਪਣੇ ਆਸਨ ਕਰਦੇ ਹਾਂ ਤਾਂ ਸਾਡੀ ਚਰਬੀ ਹੈ ਉਹ ਵੀ ਘੱਟ ਹੁੰਦੀ ਹੈ ਥੈਂਕ ਯੂ